ਜੇਕਰ ਮੈਂ ਪੰਜਾਬ ਦੇ ਪਹਿਰਾਵੇ ਦੀ ਗੱਲ ਕਰਾਂ ਤਾਂ ਸਲਵਾਰ ਸੂਟ ਪਟਿਆਲਾ ਸ਼ਾਹੀ ਸੂਟ ਪਲਾਜ਼ੋ ਲਹਿੰਗਾ ਚੋਲੀ ਅਤੇ ਘੱਗਰਾ ਜੋ ਕਿ ਗਿੱਧੇ ਵਿੱਚ ਲੋਕ ਗੀਤਾਂ ਵਿੱਚ ਵੀ ਪਹਿਨਿਆ ਜਾਂਦਾ ਅਤੇ ਇਹ ਸਾਡੇ ਸੱਭਿਆਚਾਰਕ ਨੂੰ ਦਰਸਾਉਂਦੀ ਹੈ ਲੜਕੇ ਵੀ ਪਟਿਆਲਾ ਸ਼ਾਹੀ ਪੱਗ ਬੰਨ੍ਹਦੇ ਹਨ ਮੈਂ ਵੀ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨਾਂ ਵਾਲੇ ਪੰਜਾਬੀ ਸੂਟ ਘੱਗਰਾ ਪੈਚਵਰਕ ਦੀ ਮਦਦ ਨਾਲ ਬਹੁਤ ਸਾਰੇ ਕੱਪੜੇ ਡਿਜ਼ਾਈਨ ਕੀਤੇ ਹਨ ਇਸਦੇ ਨਾਲ ਹੀ ਗੋਟਾ ਪੱਤੀ ਲੈਸਾਂ ਲਗਾ ਕੇ ਵੀ ਗਿੱਧੇ ਦੇ ਕੱਪੜੇ ਅਲੱਗ ਅਲੱਗ ਪੈਟਰਨ ਵਿੱਚ ਤਿਆਰ ਕੀਤੇ ਹੈ